ਹਾਂਜੀ ਟਰੈਵਲ ਏਜੰਸੀ ਤੋਂ ਬੋਲ ਰਿਹਾ ਟਰਾਂਸਪੋਰਟ ਕੀ ਕੀ ਹੁੰਦਾ ਜੀ ਆਪਣੇ ਕੋਲ ਮਤਲਬ ਟਰਾਂਸਪੋਰਟ ਦੇ ਵਿੱਚ ਕਾਫ ਕੀ ਕੀ ਓਕੇ ਨਹੀਂ ਨਹੀਂ ਰਿਕੁਆਇਰਮੈਂਟ ਮੇਰਾ ਬਿਜਨਸ ਆ ਦੇਖੋ ਮੇਰੇ ਕੋਲ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਅਸੀਂ ਆਪ ਹੀ ਜਾਣਾ ਹੁੰਦਾ ਅਸੀਂ ਦੇ ਵਿੱਚ ਸਾਡੇ ਘਰ ਗਾਈਆਂ ਵੀ ਹੈਗੀਆਂ ਨੇ ਠੀਕ ਆ ਇੱਕ ਮੇਰੇ ਬਿਜਨਸ ਖਿਆਲਤ ਵੀ ਨੇ ਅਤੇ ਹੋਰ ਵੀ ਹੈਗਾ ਅਤੇ ਤੁਸੀਂ ਕਿੰਨੇ ਟਾਈਮ ਦੇ ਵਿੱਚ ਗੱਡੀ ਜਾਂ ਕੋਈ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਟਰਾਂਸਪੋਰਟ ਅਵੇਲੇਬਲ ਕਰ ਸਕਦੇ ਹੋ ਨਹੀਂ ਵਿਦਿਨ ਟਾਈਮ ਦੱਸੋ ਨਾ ਲੋਕੇਸ਼ਨ ਤੁਹਾਡੀ ਕਿੱਥੇ ਆ ਠੀਕ ਹੈ ਲੁਧਿਆਣੇ ਤੋਂ ਮੰਨ ਲਓ ਜੇ ਅਸੀਂ ਲੁਧਿਆਣੇ ਆਉਣਾ ਹੋਵੇ ਉੱਥੇ ਵੀ ਪ੍ਰੋਵਾਈਡ ਕਰ ਦੋਂਗੇ ਜਿਵੇਂ ਤੁਸੀਂ ਸੱਠ ਕਿਲੋਮੀਟਰ ਸੱਤਰ ਤੋਂ ਅਸੀਂ ਉੱਥੋਂ ਕੋਈ ਸਮਾਨ ਲੈ ਕੇ ਆਉਣਾ ਸਾਡੇ ਕਿਸੇ ਬੰਦੇ ਨੇ ਜਾਣਾ ਜਾਂ ਉੱਧਰੋਂ ਲੈਣਾ ਉੱਧਰੋਂ ਵੀ ਪਿੱਕ ਕਰਵਾ ਸਕਦੇ ਹੋ ਤੁਸੀਂ ਓਕੇ ਤੁਸੀਂ ਯਾਨੀ ਪੂਰਾ ਪੰਜਾਬ ਕਵਰ ਕਰਦੇ ਹੋ ਜਾਂ ਕੁਛ ਏਰੀਏ ਨੇ ਤੁਹਾਡੇ ਠੀਕ ਆ ਅਤੇ ਮਤਲਬ ਕਦੇ ਵੀ ਤੁਸੀਂ ਅਵੇਲੇਬਲ ਟਵੈਂਟੀ ਫੋਰ ਆਵਰ ਤੋਂ ਠੀਕ ਆ ਅਤੇ ਜਿਹੜਾ ਤੁਸੀਂ ਇਹਦੀ ਪੇਮੈਂਟ ਆ ਹੈਲੋ ਪੇਮੈਂਟ ਕਿਵੇਂ ਆ ਤੁਹਾਡੀ ਕਿਲੋਮੀਟਰ ਦੇ ਹਿਸਾਬ ਨਾਲ ਜਾਂ ਕਿੱਦਾਂ

ਅਤੇ ਟਰਾਂਸਪੋਰਟ ਦੇ ਵਿੱਚ ਜਿਵੇਂ ਕਾਰ ਆ ਉਹਦਾ

ਇਹ ਸਿੰਗਲ ਵੀ ਕਰਦੇ ਹੋ ਅਤੇ ਅਪ ਡਾਊਨ ਵੀ ਹੈਂ ਜੀ ਜਿਵੇਂ ਮੰਨ ਲਓ ਕੋਈ ਬਿਜ਼ਨਸ ਮੀਟਿੰਗ ਆ ਸਾਡੀ ਮੰਨ ਲਓ ਸਾਨੂੰ ਕਿਸੇ ਹੋਰ ਸ਼ਹਿਰ 'ਚ ਬੁਲਾਇਆ ਗਿਆ ਅਤੇ ਉੱਥੇ ਰਾਤ ਦਾ ਅਤੇ ਫਿਰ ਉਹਦਾ ਚਾਰਜਸ ਅਲੱਗ ਹੋਵੇਗਾ ਨਾ ਨਹੀਂ ਨਹੀਂ ਜਿਹੜੀ ਫਿਰ ਰਾਤ ਆ ਨਹੀਂ ਨਹੀਂ ਦੇਖੋ ਮੇਰੀ ਤੁਸੀਂ ਗੱਲ ਨਹੀਂ ਸਮਝੇ ਹੁਣ ਅੱਠ ਘੰਟੇ ਅਸੀਂ ਚਲੇ ਗਏ ਅੱਠ ਦਾ ਤੁਸੀਂ ਦਸ ਰੁਪਏ ਕਿਲੋਮੀਟਰ ਦੇ ਨਾਲ ਹਰੀ ਅੱਸੀ ਕਿਲੋਮੀਟਰ ਹੋ ਗਿਆ ਉਹਦੇ ਨਾਲ ਕਰ ਲਿਆ ਉਸ ਤੋਂ ਬਾਅਦ ਆਪਾਂ ਮੰਨ ਲਓ ਦੁਪਹਿਰੇ ਚਲੇ ਗਏ ਦੁਪਹਿਰੇ ਵੀ ਰਾਤ ਵੀ ਖੜ੍ਹ ਗਏ ਤਾਂ ਉਹਦਾ ਨਹੀਂ ਨਹੀਂ ਤੁਸੀਂ ਫਿਰ ਵਾਪਸ ਆਓਂਗੇ ਓਕੇ

ਮਤਲਬ ਉੱਥੇ ਅਸੀਂ ਮਤਲਬ ਪਹੁੰਚ ਕੇ ਤੁਹਾਡੇ ਨਾਲ ਬਸ ਡਨ ਅਤੇ ਉੱਥੇ ਅਸੀਂ ਓ ਬਸ ਹਾਂ ਸਿੰਗਲ ਦਾ ਤੁਸੀਂ ਜਿੰਨਾ ਵੀ ਤੁਹਾਡਾ ਬਣਿਆ ਓਨੇ ਤੁਸੀਂ ਲੈ ਕੇ ਓਕੇ ਨਹੀਂ ਅਪ ਡਾਊਨ ਮੈਂ ਤੁਹਾਨੂੰ ਦੱਸੋ ਜਿਵੇਂ ਰਾਤ ਰੁਕਣਾ ਪੈ ਗਿਆ ਕਿਸੀ ਹੋਟਲ ਵਗੈਰਾ 'ਚ ਨਹੀਂ ਸਾਡੀ ਮੀਟਿੰਗ ਡਨ ਹੋਈ ਅਤੇ ਕ ਦੂਜੇ ਦਿਨ ਅਤੇ ਫਿਰ ਉਹਦਾ ਚਾਰਜਸ ਤੁਸੀਂ ਕਿਤੇ ਆਓ ਇੱਥੇ ਆਪਾਂ ਬੈਠ ਕੇ ਗੱਲ ਕਰੀਏ ਜਿਹੜਾ ਕੋਂਟ੍ਰੈਕਟ ਆ ਨਾ ਇਹਦਾ ਠੀਕ ਆ ਓ ਫਿਰ ਡੀਲ ਇੱਦਾਂ ਨਾ ਵੀ ਪੱਕੀ ਕਰੀਏ ਮਹੀਨੇ ਲਈ ਲਾ ਲਓ ਜਾਂ ਕੋਈ ਵੀ ਤੁਹਾਡਾ ਕੋਂਟ੍ਰੈਕਟ ਸਾਈਨ ਹੋਵੇ ਵੀ ਆਪਾਂ ਓਨਾ ਚਿਰ ਸਾਨੂੰ ਐਏਂ ਚਾਹੀਦਾ ਕਦੋਂ ਵੀ ਚੌਵੀ ਘੰਟਿਆਂ ਦੇ ਵਿੱਚ ਹਾਂਜੀ ਹਾਂ ਹਾਂ ਚਲੋ ਫਿਰ ਠੀਕ ਆ ਤੁਸੀਂ ਮਿਲੋ ਇੱਥੇ ਸਾਨੂੰ ਮੈਂ ਤੁਹਾਨੂੰ ਨਾ ਵਟਸਐਪ ਕਰਦਾ ਹਾਂ ਲੋਕੇਸ਼ਨ ਅਤੇ ਤੁਸੀਂ ਆਪਣਾ ਬੰਦਾ ਭੇਜੋ ਠੀਕ ਆ ਜੀ ਹਾਂਜੀ ਮੈਂ ਤੁਹਾਨੂੰ ਵਟਸਐਪ ਕਰਦਾ ਹਾਂ ਆਹੀ ਨੰਬਰ 'ਤੇ ਓਕੇ ਬਾਏ ਜੀ ਸਤਿ ਸ਼੍ਰੀ ਅਕਾਲ